ਹੈਲੋ ਸਤਿ ਸ਼੍ਰੀ ਅਕਾਲ ਨਾ ਲੈ ਵਧੀਆ ਹੋਰ ਬਾਸੁਦਾ ਕੀ ਗੱਲ ਯਾਦ ਭੁੱਲ ਗਈ ਮੇਰੀ ਹਾਂ ਮੈਂ ਵੀ ਸੋਚਿਆ ਹੀ ਕਰਦੀ ਹਾਂ ਕੁਛ ਕਰਾਂ ਅੱਗੇ ਕੁਛ ਕੋਲਜ ਵਗੈਰਾ 'ਚ ਐਡਮੀਸ਼ਨ ਲਈਏ

ਮੈਂ ਵੀ ਪਠਾਨਕੋਟ 'ਚ ਹੀ ਸੋਚ ਰਹੀ ਐਂ ਕਿ ਇੱਥੇ ਹੀ ਕੁਛ ਕਰ ਲਾ ਮੈਂ ਕੋਈ ਫਾਰਮੇਸੀ ਮੈਂ ਵੀ ਫਾਰਮੈਸੀ ਸੋਚੀ ਕਰਨੀ ਹਾਂ ਜਾਂ ਬੀ ਜਾਂ ਡੀ ਕੁਛ ਵੀ ਹੋਰ ਬਸ ਘਰ ਦੇ ਕਿੱਥੇ